ਵੈਸੇ ਤਾਂ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜ਼ਿਆਦਾ ਦਿਨਾਂ ਲਈ ਘਰੋਂ ਬਾਹਰ ਨਾ ਜਾਵਾਂ ਕਿਉਂਕਿ ਮੈਂ ਆਪਣੇ ਪੌਦਿਆਂ ਦੀ ਬਹੁਤ ਹੀ ਜ਼ਿਆਦਾ ਦੇਖਭਾਲ ਕਰਦੀ ਹਾਂ ਅਗਰ ਮੈਂ ਜ਼ਿਆਦਾਤਰ ਜ਼ਿਆਦਾ ਦਿਨ ਉਸ ਨੂੰ ਬਿਨਾ ਪਾਣੀ ਦਿੱਤੇ ਜਾਂ ਉਸਦੀ ਬਿਨਾ ਦੇਖਭਾਲ ਦਿੱਤੇ ਛੱਡ ਦੇਵਾਂ ਤਾਂ ਮੇਰੇ ਪੌਦੇ ਜੋ ਖਰਾਬ ਹੋ ਸਕਦੇ ਹਨ ਇਸ ਲਈ ਅਗਰ ਕਈ ਵਾਰ ਜਾਣਾ ਪੈ ਜਾਵੇ ਤਾਂ ਮੈਂ ਸਾਡੇ ਘਰ ਵਿੱਚ ਜ਼ਿਆਦਾਤਰ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਅਗਰ ਪਲੈਨ ਬਣੇ ਤਾਂ ਘਰ ਵਿੱਚ ਕੋਈ ਇੱਕ ਅੱਧਾ ਮੈਂਬਰ ਘਰ ਹੀ ਰਹਿੰਦਾ ਹੈ ਤਾਂ ਕਿ ਜੋ ਪੌਦਿਆਂ ਦੀ ਦੇਖਭਾਲ ਕਰ ਸਕੇ ਅਗਰ ਫਿਰ ਵੀ ਸਾਰਿਆਂ ਨੇ ਜਾਣਾ ਹੋਵੇ ਇੱਕ ਅੱਧੇ ਦਿਨ ਲਈ ਸਾਡਾ ਇੱਕ ਜਾਂ ਦੋ ਦਿਨ ਲਈ ਬਾਹਰ ਦਾ ਪਲੈਨ ਬਣਦਾ ਤਾਂ ਮੈਂ ਇਹ ਕਰਦੀ ਹਾਂ ਕਿ ਮੈਂ ਪੌਦਿਆਂ ਨੂੰ ਪਾਣੀ ਦੇ ਕੇ ਉਸਨੂੰ ਸਿੱਧਾ ਧੁੱਪ ਵਿੱਚ ਨਹੀਂ ਰੱਖਦੀ ਉਸ ਅਗਰ ਤਾਂ ਮੈਂ ਪੌਦੇ ਗਮਲੇ ਵਿੱਚ ਲਗਾਏ ਹਨ ਤਾਂ ਮੈਂ ਗਮਲਿਆਂ ਨੂੰ ਕੋਸ਼ਿਸ਼ ਕਰਦੀ ਹਾਂ ਕਿ ਗਮਲੇ ਚੱਕ ਕੇ ਅੰਦਰ ਰੱਖ ਦੇਵਾਂ ਜਿੱਥੇ ਉਹਨਾਂ ਦੀ ਸਿੱਧੀ ਧੁੱਪ ਨਾ ਪਵੇ ਕਿਉਂਕਿ ਅਗਰ ਪੌਦੇ 'ਤੇ ਜ਼ਿਆਦਾ ਟਾਈਮ ਧੁੱਪ ਪਵੇ ਤਾਂ ਪੌਦੇ ਜੋ ਜੋ ਧੁੱਪ ਹੈ ਉਹ ਵੀ ਪਾਣੀ ਸੋਖ ਲੈਂਦੀ ਹੈ ਅਤੇ ਪੌਦੇ ਜੋ ਸੁੱਕ ਜਾਂਦੇ ਹਨ ਅਤੇ ਸਿੱਧੀ ਧੁੱਪ ਪੈਣ ਨਾਲ ਪੌਦੇ ਖਰਾਬ ਵੀ ਹੋ ਸਕਦੇ ਹਨ ਜ਼ਿਆਦਾ ਟਾਈਮ ਅਗਰ ਪੌਦਿਆਂ ਦੇ ਧੁੱਪ ਪੈਂਦੀ ਰਹੇ ਅਤੇ ਉਸਨੂੰ ਪਾਣੀ ਨਾ ਦਿੱਤਾ ਜਾਵੇ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਪੌਦਿਆਂ ਨੂੰ ਅੰਦਰ ਗਮਲਿਆਂ ਨੂੰ ਅੰਦਰ ਰੱਖ ਦਿੱਤਾ ਜਾਵੇ ਅਗਰ ਬਾਹਰ ਲਗਾਏ ਹੋਏ ਹਨ ਪੌਦੇ ਤਾਂ ਮੈਂ ਉਸਨੂੰ ਉਸ 'ਤੇ ਥੋੜ੍ਹੀ ਛਾਂ ਕਰਕੇ ਰੱਖ ਦਿੰਦੀ ਹਾਂ ਤਾਂ ਕਿ ਜੋ ਉਸ ਵਿੱਚ ਮੋਇਸਚਰ ਲੈਵਲ ਹੈ ਉਹ ਬਣਿਆ ਰਹੇ ਇਸ ਤਰੀਕੇ ਨਾਲ ਮੈਂ ਪੌਦਿਆਂ ਦੀ ਦੇਖਭਾਲ ਕਰਦੀ ਹਾਂ ਅਗਰ ਮੈਨੂੰ ਘਰ ਤੋਂ ਕਿਤੇ ਬਾਹਰ ਜਾਣਾ ਪੈ ਜਾਵੇ ਤਾਂ ਕਿ ਜੋ ਮੇਰੇ ਪੌਦੇ ਆ ਉਹ ਖਰਾਬ ਨਾ ਹੋ ਸਕਣ ਜਲਦੀ